ਭਾਅ ਜੀ ਸਤਿ ਸ਼੍ਰੀ ਅਕਾਲ ਜੀ ਭਾਅ ਜੀ ਗਿੱਲ ਟੈਲੀਕੋਮ ਤੋਂ ਬੋਲਦੇ ਭਾਅ ਜੀ ਭਾਅ ਜੀ ਮੈਂ ਤਾਂ ਲੈਪਟਾਪ ਲਿਆ ਸੀ ਲੈਪਟਾਪ ਬਹੁਤ ਖਰਾਬ ਚੱਲਦਾ ਆ ਅਤੇ ਤੀਜੇ ਦਿਨ ਭਾਅ ਜੀ ਇਹਦੀ ਵਿੰਡੋ ਉੜ ਜਾਂਦੀ ਹੈ ਐਂ ਇੰਨੀ ਇਹ ਸਕਰੀਨ ਇਹਦੀ ਜੇ ਕੋਈ ਫਾਈਲ ਫੂਈਲ ਖੋਲਣੀ ਪੈਂਦੀ ਆ ਅਤੇ ਇਹਨੂੰ ਚਾਰਜ ਲਗਾਉਣਾ ਪੈਂਦਾ ਫਾਈਲ ਖੋਲ੍ ਕੇ ਫਿਰ ਫਾਈਲ ਖੁੱਲਦੀ ਹੈ ਭਾਅ ਜੀ ਇਹਦੀ ਇਹ ਧੂੜ ਇੰਨੀ ਧੂੜ ਜੰਮੀ ਹੋਈ ਇਹਦੇ ਉੱਤੇ ਕੋਈ ਹੱਦ ਨਹੀਂ ਹੈਗੀ ਧੂੜ ਦੀ ਅਤੇ ਸਾਈਡਾਂ ਵਾਲੇ ਬਟਨ ਨਹੀਂ ਚੱਲਦੇ ਐਂ ਦੱਬ ਘੁੱਟ ਕੇ ਦੱਬਣੇ ਪੈਂਦੇ ਫਿਰ ਜਾਕੇ ਭਾਅ ਜੀ ਸਾਈਡਾਂ ਵਾਲੇ ਬਟਨ ਚੱਲਦੇ ਆ ਭਾਅ ਜੀ ਇਹਦੇ ਹੈਂ ਭਾਅ ਜੀ ਪੀਸ ਬਹੁਤ ਖਰਾਬ ਦਿੱਤਾ ਵਧੀਆ ਪੀਸ ਨਹੀਂ ਦਿੱਤਾ ਤੁਹਾਡੀ ਮਾਰਕੀਟ 'ਤੇ ਭਾਅ ਜੀ ਬਹੁਤ ਗੰਦਾ ਪ੍ਰਭਾਵ ਪੈਂਦਾ ਭਾਅ ਜੀ ਤੁਹਾਡਾ ਸਾਈਡਾਂ ਵਾਲੇ ਬਟਨ ਹੋ ਗਏ ਸਕਰੀਨ 'ਤੇ ਧੂੜ ਜੰਮੀ ਓ ਆ ਪਤਾ ਨਹੀਂ ਕਿੱਦਾਂ ਦਾ ਪੀਸ ਤੁਸੀਂ ਮੈਨੂੰ ਚੁੱਕ ਕੇ ਦੇ ਦਿੱਤਾ ਬਹੁਤ ਖਰਾਬ ਪੀਸ ਚੁੱਕ ਕੇ ਤੁਸੀਂ ਮੈਨੂੰ ਦਿੱਤਾ ਮੈਨੂੰ ਵਧੀਆ ਪੀਸ ਦਿਓ ਠੀਕ ਆ ਮੈਂ ਤੁਹਾਡੀ ਦੁਕਾਨ 'ਤੇ ਆਉਣਾ ਆ ਮੈਨੂੰ ਸ਼ੋਪ ਤੋਂ ਮੈਨੂੰ ਵਧੀਆ ਲੈਪ ਲੈਪਟੋਪ ਦੁਆਰਾ ਐਕਸਚੇਂਜ ਕਰਕੇ ਦਿਓ ਭਾਅ ਜੀ ਮੈਨੂੰ ਬਹੁਤ ਖਰਾਬ ਚੱਲਦਾ ਲੈਪਟੋਪ ਇਹ ਇਹਦੀ ਚਾਰਜ ਲਗਾ ਕੇ ਭਾਅ ਜੀ ਇਹਦੀ ਫਾਈਲ ਖੋਲਣੀ ਪੈਂਦੀ ਆ ਤਾਂ ਨਹੀਂ ਤਾਂ ਫਿਰ ਤੀਜੇ ਦਿਨ ਵਿੰਡੋ ਉੜ ਜਾਂਦੀ ਕੱਲ੍ਹ ਭਾਅ ਜੀ ਵਿੰਡੋ ਕਰਵਾਈ ਫਿਰ ਉੜ ਗਈ ਪਰਸੋਂ ਕਰਵਾਈ ਫਿਰ ਉੜ ਗਈ ਅੱਜ ਕਰਵਾਈ ਫਿਰ ਉੜ ਗਈ ਵਿੰਡੋ ਭਾਅ ਜੀ ਇਹਦੀ ਬ ਮੈਨੂੰ ਵਧੀਆ ਲੈਪਟੋਪ ਭਾਅ ਜੀ ਦਿਓ ਪੈਸੇ ਲਗਾਏ ਆ ਸਾਨੂੰ ਚੀਜ਼ ਵੀ ਵਧੀਆ ਮਿਲਣੀ ਚਾਹੀਦੀ ਭਾਅ ਜੀ ਬੀ ਤੁਹਾਡਾ ਆਪਣੀ ਮਾਰਕੀਟ ਤੁਹਾਡਾ ਕਿੰਨਾ ਪ੍ਰ ਗੰਦਾ ਪ੍ਰਭਾਵ ਪੈਂਦਾ ਭਾਅ ਜੀ ਤੁਹਾਡਾ ਇਸ ਕਰਕੇ ਮੈਨੂੰ ਪਲੀਜ਼ ਰਿਕੁਐਸਟ ਆ ਤੁਹਾਡੇ ਅੱਗੇ ਵੀ ਮੈਨੂੰ ਪੀਸ ਚੇਂਜ ਕਰਕੇ ਦਿਓ ਭਾਅ ਜੀ ਇਹ ਸਕਰੀਨ ਬਾਈ ਇਹ ਦੋ ਵਾਰ ਇਹਦੀ ਭਾਅ ਜੀ ਸਕਰੀਨ ਪਵਾ ਲਈ ਠੀਕ ਆ ਹਜੇ ਤਾਂ ਬਰਾਂਟੀ 'ਚ ਹੈ ਇਹ ਹਜੇ ਤਾਂ ਬਰਾਂਟੀ ਵਿੱਚੇ ਆ ਬਰਾਂਟੀ ਵੇ ਮੈਨੂੰ ਪੀਸ ਪਲੀਜ ਚੇਂਜ ਕਰਕੇ ਦਿਓ ਮੈਨੂੰ ਪੀਸ ਭਾਅ ਜੀ ਇਹਦਾ ਪੀਸ ਮੈਨੂੰ ਤੁਹਾਡੇ ਅੱਗੇ ਰਿਕੁਐਸਟ ਆ ਤੁਹਾਡੀ ਮਾਰਕੀਟ ਭਾਅ ਜੀ ਆ ਆਪਣੀ ਖਰਾਬ ਹੁੰਦੀ ਆ ਠੀਕ ਆ ਆਪਾਂ ਪੈਸੇ ਲਗਾਏ ਆ ਆਪਾਂ ਨੂੰ ਚੀਜ਼ ਵਧੀਆ ਬਣਾ ਦਿਓ ਭਾਅ ਜੀ ਹਾਂ ਡੈਲ ਦਾ ਡੈਲ ਦਾ ਇੰਨੀ ਕੰਪਨੀ ਆ ਇੰਨਾ ਵਧੀਆ ਨਾਂ ਆ ਡੈਲ ਦਾ ਵਾ ਤੁਸੀਂ ਤਾਂ ਪੀਸ ਏ ਮੈਨੂੰ ਜਾ ਚੁੱਕ ਕੇ ਖਰਾਬ ਦੇ ਦਿੱਤਾ ਮੈਨੂੰ ਵਧੀਆ ਅਕਸਚੇਂਜ ਕਰਕੇ ਪਲੀਜ਼ ਮੈਨੂੰ ਪੀਸ ਦਿਓ ਕੱਲ੍ਹ ਨੂੰ ਮੈਂ ਤੁਹਾਡੀ ਸ਼ੌਪ 'ਤੇ ਭਾਅ ਜੀ ਆਉਣਾ ਹੈ ਮੈਨੂੰ ਪੀਸ ਚੇਂਜ ਕਰਕੇ ਪਲੀਜ ਮੈਨੂੰ ਦਿਓ ਭਾਅ ਜੀ ਠੀਕ ਆ ਵੀ ਆਪਾਂ ਹੁਣ ਚੀਜ਼ ਤੁਸੀਂ ਮਤਲਬ ਅਕਸਚੇਂਜ ਕਰਕੇ ਦਿਓਗੇ ਵੀ ਸ ਆਪਾਂ ਚਾਰ ਬੰਦੇ ਹੋਰ ਕਹਾਂਗੇ ਕੇ ਉਹ ਬੰਦੇ ਤੋਂ ਆਪਾਂ ਲੈਪਟਾਪ ਲਿਆ ਸੀਗਾ ਵੇ ਉਹ ਪੀਸ ਖੋਲ ਕੇ ਦੇਖਿਆ ਵੇ ਉਹ ਪੀਸ ਖ਼ਰਾਬ ਸੀ ਉਹ ਬੰਦੇ ਨੇ ਆਪਾਂ ਨੂੰ ਚੀਜ਼ ਲੈਪਟਾਪ ਚੇਂਜ ਕਰਕੇ ਦਿੱਤਾ ਠੀਕ ਹੈ ਭਾਅ ਜੀ